ਮੈਂ ਕਰਜੇ ਲਈ ਅਰਜੀ ਦੇ ਰਹੀ ਹਾਂ ਮੈਨੂੰ ਪਤਾ ਹੈ ਕਿ ਮੈਂ ਈਐਫ ਦਾ ਸਬੂਤ ਦੇਣ ਵਾਸਤੇ ਜਦੋਂ ਵੀ ਆਪਣਾ ਪੀ ਈਪੀਐਫ ਖੋਲਾਂਗੀ ਪੋਰਟਲ ਖੋਲਾਂਗੀ ਲੋਗਇਨ ਕਰਨ ਵਾਸਤੇ ਮੇਰੇ ਕੋਲ ਆਪਣਾ ਆਈਡੀ ਹੋਵੇਗਾ ਉਸ ਆਈਡੀ ਨੂੰ ਜਿੱਦਾਂ ਹੀ ਮੈਂ ਲੋਗਿਨ ਕਰਾਂਗੀ ਤਾਂ ਉਹਦੇ ਵਿੱਚ ਮੇਰੇ ਕੋਲ ਉਹ ਪਾਸਵਰਡ ਵਗੈਰਾ ਮੰਗੇਗੀ ਮੰਗਣਗੇ ਉਸ ਪਾਸਵਰਡ ਨੂੰ ਮੈਂ ਉਹਦੇ ਵਿੱਚ ਭਰ ਦਵਾਂਗੀ ਫਿਰ ਉਸ ਪਾਸਵਰਡ ਨੂੰ ਭਰਨ ਤੋਂ ਬਾਅਦ ਉਹ ਸਾਰੀ ਡਿਟੇਲ ਆ ਜਾਏਗੀ ਜੋ ਕਿ ਉਸ ਪੋਰਟਲ 'ਤੇ ਲੋੜੀਂਦੀ ਹੈ ਉਸ ਪੋਰਟਲ 'ਤੇ ਲੋੜੀਂਦੀ ਡਿਟੇਲ ਨੂੰ ਭਰਨ ਤੋਂ ਬਾਅਦ ਮੈਨੂੰ ਪਤਾ ਲੱਗ ਜਾਵੇਗਾ ਕਿ ਉਹਦੇ ਵਿੱਚ ਕਿੰਨੇ ਪੈਸੇ ਮੇਰੀ ਕੰਪਨੀ ਦੇ ਰਹੀ ਹੈ ਅਤੇ ਕਿੰਨੇ ਪੈਸੇ ਮੇਰੇ ਵੱਲੋਂ ਉੱਥੇ ਮੇਰੀ ਤਨਖਾਹ ਵਿੱਚੋਂ ਜੋੜੇ ਜਾ ਰਹੇ ਹਨ ਫਿਰ ਉਸ ਤੋਂ ਬਾਅਦ ਮੈਂ ਉਸ ਪੋਰਟਲ ਨੂੰ ਓਪਨ ਕਰਕੇ ਇੱਕ ਆਨਲਾਈਨ ਐਪਲੀਕੇਸ਼ਨ ਦਵਾਂਗੀ ਜਿਹਦੇ ਵਿੱਚ ਮੈਂ ਆਪਣੀ ਅਰਜੀ ਦਵਾਂਗੀ ਕਿ ਮੈਂ ਕਿੰਨੇ ਪੈਸੇ ਲੋਨ ਵਿੱਚ ਲੈਣਾ ਚਾਹੁੰਦੀ ਹਾਂ ਅਤੇ ਉਸ ਲੋਨ ਦੀ ਅਰਜੀ ਤਿਆਰ ਕਰ ਲਵਾਂਗੀ ਅਤੇ ਫਿਰ ਮੈਂ ਉਸ ਐਪਲੀਕੇਸ਼ਨ ਨੂੰ ਇਸ ਆਈਡੀ ਨੰਬਰ ਨੂੰ ਲੈ ਕੇ ਉਹਦੇ ਵਿੱਚ ਆਨਲਾਈਨ ਅਪਲਾਈ ਕਰ ਦਵਾਂਗੀ ਅਤੇ ਮੇਰੀ ਇਸ ਐਪਲੀਕੇਸ਼ਨ ਨੂੰ ਇਸ ਪੋਰਟਲ ਦੁਆਰਾ ਸਵੀਕਾਰ ਕਰ ਲਿਆ ਜਾਏਗਾ ਅਤੇ ਫਿਰ ਮੈਨੂੰ ਇਸ ਪੋਰਟਲ ਦੁਆਰਾ ਪੈਸੇ ਅਰਜੀ ਲੋਨ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਅਤੇ ਮੇਰੇ ਦੁਆਰਾ ਪ੍ਰਾਪਤ ਕੀਤੀ ਗਈ ਲੋਨ ਦੀ ਰਾਸ਼ੀ ਲਈ ਮੈਂ ਉਸ ਕੰਪਨੀ ਨੂੰ ਧੰਨਵਾਦੀ ਹੋਵਾਂਗੀ